ਮੈਨੂੰ ਗੀਤ ਗਾਉਣ ਦਾ ਬਹੁਤ ਸ਼ੌਂਕ ਹੈ ਮੈਂ ਵੱਖ ਵੱਖ ਭਾਸ਼ਾਵਾਂ ਦੇ ਗੀਤ ਸੁਣਦਾ ਹਾਂ ਅਤੇ ਗਾਉਣੇ ਪਸੰਦ ਕਰਦਾ ਹਾਂ ਮੈਂ ਇੰਗਲਿਸ਼ ਗਾਣੇ ਅਤੇ ਪੰਜਾਬੀ ਗੀਤ ਅਤੇ ਤੇਲਗੂ ਗੀਤ ਹਰਿਆਣਵੀ ਗੀਤ ਸਾਰੇ ਹੀ ਗਾ ਲੈਂਦਾ ਹਾਂ ਜੇ ਮੈਂ ਕਿਸੇ ਗੀਤ ਗਾਉਣ ਦੀ ਤਿਆਰੀ ਕਰਦਾ ਹਾਂ ਸਭ ਤੋਂ ਪਹਿਲਾਂ ਮੈਂ ਉਸ ਗੀਤ ਦੀ ਬੀਟ ਨੂੰ ਅਤੇ ਉਸ ਗੀਤ ਨੂੰ ਚੰਗੀ ਤਰ੍ਹਾਂ ਸਮਝਦਾ ਹਾਂ ਅਤੇ ਉਸ ਗੀਤ ਦੀ ਤਿਆਰੀ ਕਰਦਾ ਹਾਂ ਤਾਂ ਜਾ ਕਰ ਉਸ ਗੀਤ ਨੂੰ ਮੈਂ ਗਾਉਂਦਾ ਹਾਂ ਇਸ ਤਰ੍ਹਾਂ ਮੈਂ ਵੱਖ ਵੱਖ ਗੀਤਾਂ ਭਾਸ਼ਾਵਾਂ ਦੇ ਗੀਤਾਂ ਨੂੰ ਮੈਂ ਗਾ ਸਕਦਾ ਹਾਂ